ਜਦੋਂ ਅਸੀਂ ਰਸੋਈ ਦੇ ਵਿੱਚ ਦਾਖਲ ਹੁੰਦੇ ਹਾਂ ਤਾਂ ਅਸੀਂ ਆਪਣੇ ਪਰਿਵਾਰ ਦੇ ਲਈ ਸਾਰਾ ਦਿਨ ਕੁਝ ਨਾ ਕੁਝ ਜਿਹੜੇ ਪਕਵਾਨ ਹਨ ਉਹ ਬਣਾ ਕੇ ਉਹਨਾਂ ਨੂੰ ਦਿੰਦੇ ਹਾਂ ਉਹਨਾਂ ਵਿੱਚੋਂ ਸਭ ਤੋਂ ਸਾਰਿਆਂ ਦਾ ਮਨ ਪਸੰਦ ਜਿਹੜਾ ਪਕਵਾਨ ਹੈ ਉਹ ਹੈ ਕੜੀ ਕੜੀ ਬਣਾਉਣ ਵਾਸਤੇ ਅਸੀਂ ਸਭ ਤੋਂ ਪਹਿਲਾਂ ਪਕੌੜੇ ਤਿਆਰ ਕਰਦੇ ਹਾਂ ਪਕੌੜਿਆਂ ਵਾਸਤੇ ਅਸੀਂ ਕਰਿਆਟੀ ਲੈਂਦੇ ਹਾਂ ਕਰਿਆਟੀ ਲੈਣ ਤੋਂ ਬਾਅਦ ਅਸੀਂ ਲੂਣ ਮਿਰਚ ਮਸਾਲਾ ਹਲਕਾ ਜੀਰਾ ਅਤੇ ਦਹੀਂ ਦਾ ਇੱਕ ਚਮਚ ਅਸੀਂ ਕਰਿਆਟੀ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਤੇ ਵਿੱਚ ਛੋਟੇ ਛੋਟੇ ਪੀਸ ਕੱਟ ਕੇ ਆਲੂ ਅਤੇ ਪਿਆਜ਼ ਦੇ ਅਤੇ ਅਸੀਂ ਜਿਹੜੇ ਹਨ ਪਕੌੜੇ ਉਹ ਕੱਢ ਲੈਂਦੇ ਹਾਂ ਉਸ ਤੋਂ ਬਾਅਦ ਅਸੀਂ ਦੂਜੇ ਪਾਸੇ ਪਤੀਲੇ ਦੇ ਵਿੱਚ ਤੜਕਾ ਤਿਆਰ ਕਰਦੇ ਹਾਂ ਜਿਹਦੇ ਵਿੱਚ ਕਿ ਅਸੀਂ ਲਸਣ ਦਾ ਪਿਆਜ਼ ਦਾ ਮੇਥੇ ਜੀਰਾ ਅਸੀਂ ਇਹਨਾਂ ਦੀ ਵਰਤੋਂ ਕਰਕੇ ਅਦਰਕ ਜਿਹੜਾ ਹੈ ਉਹ ਪਾਉਂਦੇ ਹਾਂ ਅਤੇ ਅਸੀਂ ਸਭ ਤੋਂ ਪਹਿਲਾਂ ਅਸੀਂ ਲੱਸੀ ਲੈ ਕੇ ਲੱਸੀ ਦੇ ਵਿੱਚ ਥੋੜ੍ਹੀ ਜਿਹੀ ਕਰਿਆਟੀ ਜਿਹੜੀ ਹੈਗੀ ਆ ਉਹ ਬਿਲਕੁਲ ਘੋਲ ਲੈਂਦੇ ਹਾਂ ਥੋੜ੍ਹੀ ਜਿਹੀ ਲੱਸੀ ਥੋੜ੍ਹੀ ਜਿਹੀ ਕਰਿਆਟੀ ਬਿਲਕੁਲ ਘੋਲ ਕੇ ਤਾਂ ਕਿ ਜਿਹੜੀ ਉਹਨਾਂ ਦੀ ਡਲੀ ਹੈ ਉਹ ਬਿਲਕੁਲ ਮਰ ਜਾਵੇ ਅਤੇ ਅਸੀਂ ਪੇਸਟ ਤਿਆਰ ਕਰ ਲੈਦੇ ਹਾਂ ਉਸ ਤੋਂ ਬਾਅਦ ਜਿਹੜੀ ਬਾਕੀ ਦੀ ਲੱਸੀ ਹੈ ਉਹਨੂੰ ਵਿੱਚ ਐਡ ਕਰ ਦੇਣਾ ਅਤੇ ਇੱਕ ਪੂਰਾ ਜੱਗ ਭਰ ਕੇ ਅਸੀਂ ਜਿਹੜਾ ਇਹ ਘੋਲ ਤਿਆਰ ਕਰਨਾ ਜਿਹਦੇ ਵਿੱਚ ਕਿ ਲੱਸੀ ਔਰ ਕਰਿਆਟੀ ਦਾ ਘੋਲ ਹੁੰਦਾ ਹੈ ਅਤੇ ਉੱਧਰ ਅਸੀਂ ਆਪਣਾ ਤੜਕਾ ਜਿਹੜਾ ਹੈਗਾ ਉਹ ਬਿਲਕੁਲ ਰੈਡੀ ਕਰ ਲਿਆ ਤੜਕਾ ਰੈਡੀ ਕਰਨ ਤੋਂ ਬਾਅਦ ਅਸੀਂ ਜਿਹੜਾ ਉਹ ਘੋਲ ਹੈ ਉਹਨੂੰ ਵਿੱਚ ਪਾ ਦੇਣਾ ਹੈ ਪਤੀਲੇ ਦੇ ਵਿੱਚ ਪਾ ਦੇਣਾ ਹੈ ਅਤੇ ਉਹਦੇ ਬਾਅਦ ਵਿੱਚੋਂ ਅਸੀਂ ਜਦੋਂ ਕੜੀ ਕਾਫੀ ਪੱਕ ਜਾਂਦੀ ਹੈ ਅਤੇ ਕੜੀ ਉਤਾਰਨ ਤੋਂ ਪੰਜ ਸੱਤ ਕੁ ਮਿੰਟ ਪਹਿਲਾਂ ਅਸੀਂ ਜਿਹੜੇ ਪਕੌੜੇ ਹਨ ਉਹ ਬਾਅਦ ਵਿੱਚੋਂ ਉਹਦੇ ਵਿੱਚ ਪਾਉਣੇ ਹਨ ਤਾਂ ਕਿ ਸਾਡੇ ਜਿਹੜੇ ਪਕੌੜੇ ਹਨ ਉਹ ਘੁਲ ਕੇ ਫਟ ਨਾ ਜਾਣ ਅਤੇ ਉਹ ਥੋੜ੍ਹੇ ਥੋੜ੍ਹੇ ਗਿੱਲੇ ਹੋਣ ਅਤੇ ਉਹ ਉਵੇਂ ਦੇ ਉਵੇਂ ਸਵਾਦਿਸ਼ ਕੜੀ ਜਿਹੜੀ ਹੈਗੀ ਉਹ ਤਿਆਰ ਹੋ ਜਾਵੇ ਦੂਜੇ ਨੰਬਰ 'ਤੇ ਜਿਹੜੀ ਹੈਗੀ ਆ ਅਸੀਂ ਆਮਲੇ ਦਾ ਮੁਰੱਬਾ ਜਿਹੜਾ ਹੈਗਾ ਜਦੋਂ ਅਸੀਂ ਆਮਲੇ ਦਾ ਮੁਰੱਬਾ ਪਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੇ ਅਸੀਂ ਅ ਔਲੇ ਹਨ ਨੀਚੇ ਅਸੀਂ ਕੜਾਹੇ ਕੋਈ ਵੀ ਵੱਡਾ ਭਾਂਡਾ ਲੈ ਕੇ ਉਹਦੇ ਵਿੱਚ ਪਾਣੀ ਰੱਖ ਲੈਣਾ ਹੈ ਪਾਣੀ ਰੱਖਣ ਤੋਂ ਬਾਅਦ ਉਹਦੇ ਉੱਪਰ ਕੋਈ ਵੀ ਛਾਣਨੀ ਲੈ ਲਓ ਛਾਣਨੀ ਦੇ ਵਿੱਚ ਤੁਸੀਂ ਜਿਹੜੇ ਹਨ ਆਮਲੇ ਹਨ ਉਹਨਾਂ ਨੂੰ ਤੁਸੀਂ ਪੂਰੀ ਤਰ੍ਹਾਂ ਵਿਛਾ ਦਿਓ ਵਿਛਾ ਕੇ ਉੱਪਰ ਹਲਕਾ ਜਿਹਾ ਇੱਕ ਢੱਕਣ ਦੇ ਦਿਓ ਤਾਂ ਕਿ ਉਹਨਾਂ ਨੂੰ ਭਾਫ ਲੱਗ ਸਕੇ

ਜੂਸ ਹੈ ਉਹ ਨਿਕਲਣ ਲੱਗ ਜਾਵੇਗਾ ਅਤੇ ਇਹ ਇੱਕ ਆਮਲਿਆਂ ਦਾ ਜੂਸ ਅਤੇ ਚੀਨੀ ਨੇ ਮਿਲ ਕੇ ਇੱਕ ਬਹੁਤ ਵਧੀਆ ਇੱਕ ਤਰਲ ਪਦਾਰਥ ਬਣ ਜਾਣਾ ਆ ਇੱਕ ਚਾਸ਼ਣੀ ਟਾਈਪ ਬਣ ਜਾਣਾ ਅਤੇ ਉਹਦੇ ਵਿੱਚ ਅਸੀਂ ਜਿਹੜੇ ਉਹ ਆਮਲੇ ਹਨ ਚੰਗੀ ਤਰ੍ਹਾਂ ਉਹਨਾਂ ਨੂੰ ਅਸੀਂ ਫਰਾਈ ਕਰ ਲੈਣਾ ਹਲਕੀ ਲਾਲੀ 'ਤੇ ਜਦੋਂ ਉਹ ਮੁਰੱਬਾ ਆ ਜਾਂਦਾ ਹੈ ਤਾਂ ਉਹ ਵਾਲਾ ਮੁਰੱਬਾ ਜਿਹੜਾ ਹੈ ਉਹ ਤਿਆਰ ਹੈ

ਕੜਾਹੀ ਜਿਹੜੀ ਹੈ ਉਹ ਉਹਦੇ ਵਿੱਚ ਤੇਲ ਪਾ ਦੇਣਾ ਹੈ ਤੇਲ ਬਿਲਕੁਲ ਜਦੋਂ ਗਰਮ ਹੋ ਜਾਂਦਾ ਹੈ ਤਾਂ ਉਹ ਅਸੀਂ ਜਿਹੜੇ ਕਰੇਲੇ ਹਨ ਉਹਦੇ ਵਿੱਚ ਹੌਲੀ ਹੌਲੀ ਅਸੀਂ ਜਿਹੜੇ ਕਰੇਲੇ ਹਨ ਉਹ ਮਸਾਲੇ ਨਾਲ ਭਰੇ ਹੋਏ ਕਰੇਲੇ ਜਿਹੜੇ ਛੱਡ ਦੇਣੇ ਹਨ ਜਦੋਂ ਇਹ ਹਲਕੇ ਹਲਕੇ ਬਰਾਊਨ ਹੋ ਜਾਂਦੇ ਹਨ ਭੂਰੇ ਹੋ ਜਾਣ ਤਾਂ ਉਸ ਵੇਲੇ ਅਸੀਂ ਇਹਨਾਂ ਨੂੰ ਕੱਢ ਕੇ ਬਾਹਰ ਰੱਖ ਲੈਣਾ